ਅੱਜ ਦੇ ਆਧੁਨਿਕ ਸਮੇਂ ਵਿੱਚ ਟੈਕਨੋਲੋਜੀ ਦਾ ਦੇਸ਼ ਦੇ ਵਿਕਾਸ ਵਿੱਚ ਬਹੁਤ ਬੜਾ ਯੋਗਦਾਨ ਹੈ ਟਕਨੋਲੋਜੀ ਨੇ ਲੋਕਾਂ ਦੀ ਜ਼ਿੰਦਗੀ ਬੜੀ ਆਸਾਨ ਬਣਾ ਦਿੱਤੀ ਹੈ ਜਿਵੇਂ ਪਹਿਲੇ ਸਮਿਆਂ ਵਿੱਚ ਆਵਾਜਾਈ ਦੇ ਸਾਧਨ ਘੱਟ ਸਨ ਸਿਹਤ ਸੇਵਾਵਾਂ ਘੱਟ ਸਨ ਸੰਚਾਰ ਦੇ ਸਾਧਨ ਘੱਟ ਸਨ ਪਰ ਅੱਜ ਬਦਲਦੇ ਯੁੱਗ ਵਿੱਚ ਇਹਨਾਂ ਸਾਧਨਾਂ ਦੀ ਮਾਤਰਾ ਭਰਪੂਰ ਹੈ ਜਿਨ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਨੂੰ ਕਾਫੀ ਆਸਾਨ ਬਣਾ ਦਿੱਤਾ ਹੈ ਲੋਕ ਇੱਕ ਥਾਂ ਤੋਂ ਦੂਜੀ ਥਾਂ ਆਵਾਜਾਈ ਦੇ ਸਾਧਨਾ ਕਰਕੇ ਛੇਤੀ ਪਹੁੰਚ ਜਾਂਦੇ ਹਨ ਮੋਬਾਈਲ ਫੋਨਾਂ ਕਰਕੇ ਲੋਕ ਦੂਰ ਬੈਠੇ ਇੱਕ ਦੂਜੇ ਨਾਲ਼ ਗੱਲ ਕਰ ਸਕਦੇ ਹਨ ਜਿੱਥੇ ਮੈਂ ਪਹਿਲਾਂ ਸ਼ੁਰੂ ਵਿੱਚ ਕੰਮ ਕਰਦੀ ਸੀ ਉੱਥੇ ਹੱਥ ਲਿਖਤ ਰਜਿਸਟਰ ਸੀ ਜਿਨ੍ਹਾਂ ਵਿੱਚ ਰਿਕੋਰਡ ਲਿਖਿਆ ਜਾਂਦਾ ਸੀ ਪਰ ਕੰਪਿਊਟਰ ਹੋਣ ਕਰਕੇ ਇਹ ਸਭ ਸੌਖਾ ਹੋ ਗਿਆ ਹੈ ਸਿਹਤ ਪੱਧਰ ਵੀ ਬਹੁਤ ਉੱਚਾ ਹੋ ਗਿਆ ਹੈ ਬਿਮਾਰੀਆਂ ਦਾ ਇਲਾਜ ਛੇਤੀ ਹੋ ਜਾਂਦਾ ਹੈ ਇਹਨਾਂ ਸਭ ਤਬਦੀਲੀਆਂ ਨੇ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ